ਹੈਲੋ ਕੀ ਤੁਸੀਂ ਫਲਿਪਕਾਰਟ ਤੋਂ ਗੱਲ ਕਰ ਰਹੇ ਹੋ ਜੀ ਮੈਂ ਕੁਛ ਦਿਨ ਪਹਿਲਾਂ ਤੁਹਾਡੇ ਤੇ ਇੱਕ ਫੋਨ ਔਡਰ ਕੀਤਾ ਸੀਗਾ ਜਿਸ ਨਾਲ ਮੇਰਾ ਤੁਹਾਡੇ ਨਾਲ ਅਨੁਭਵ ਬਹੁਤ ਚੰਗਾ ਰਿਹਾ ਮੈਂ ਇੱਕ ਰੈਡਮੀ ਦਾ ਫੋਨ ਔਡਰ ਕੀਤਾ ਸੀਗਾ ਜੋ ਕਿ ਉਹਨਾਂ ਦਾ ਸਭ ਤੋਂ ਨਵਾਂ ਫੋਨ ਹੈ ਅਤੇ ਮੈਨੂੰ ਉਸ ਦੀ ਸਭ ਤੋਂ ਚੰਗੀ ਗੱਲ ਲੱਗੀ ਕਿ ਉਸਦਾ ਕੈਮਰਾ ਬਹੁਤ ਅੱਛਾ ਹੈ ਅਤੇ ਬਹੁਤ ਹੀ ਸਾਫ ਅਤੇ ਵਧੀਆ ਫੋਟੋਆਂ ਖਿੱਚਦਾ ਹੈ ਇਹ ਫੋਨ ਕਾਫੀ ਤੇਜ਼ ਹੈ ਅਤੇ ਜਿਹੜੇ ਮੇਰੇ ਜਵਾਕ ਜੋ ਕਿ ਗੇਮਾਂ ਖੇਡਣ ਦੇ ਸ਼ੌਕੀਨ ਹਨ ਫੋਨ ਉੱਤੇ ਉਹ ਬੜੇ ਆਰਾਮ ਨਾਲ ਕੋਈ ਵੀ ਗੇਮ ਖੇਡ ਸਕਦੇ ਹਨ ਇਹ ਬਿਲਕੁਲ ਅ ਸਲੋ ਨਹੀਂ ਹੁੰਦਾ ਫੋਨ ਇਹ ਕਿਤੇ ਵੀ ਹੈਂਗ ਨਹੀਂ ਹੁੰਦਾ ਡਿਲੀਵਰੀ ਵੀ ਦਾ ਅਨੁਭਵ ਵੀ ਬਹੁਤ ਚੰਗਾ ਸੀ ਜੋ ਕਿ ਡਿਲੀਵਰਾ ਮੈਨੂੰ ਹੋਇਆ ਬਿਲਕੁਲ ਟਾਈਮ 'ਤੇ ਮੇਰੇ ਕੋਲ ਪਹੁੰਚਿਆ ਅਤੇ ਇਸਦੀ ਪੈਕਜ਼ਿੰਗ ਵੀ ਬਹੁਤ ਚੰਗੀ ਸੀ ਫੋਨ ਬਿਲਕੁਲ ਸਾਫ਼ ਸੁਥਰਾ ਮੇਰੇ ਕੋਲ ਪਹੁੰਚ ਗਿਆ ਸੀਗਾ ਜੀ ਇਸ ਬਾਰੇ ਮੈਂ ਤੁਹਾਡਾ ਧੰਨਵਾਦੀ ਹਾਂ